ਹਾਂਜੀ ਮੈਂ ਸਭ ਤੋਂ ਪਹਿਲਾਂ ਪਿਛਲੇ ਹੀ ਸਾਲ ਦੀ ਗੱਲ ਆ ਮੇਰੀਆਂ ਕੁਛ ਫਰੈਂਡਸ ਧੁੱਪ ਦੇ ਵਿੱਚ ਸਰਦੀਆਂ ਦੇ ਵਿੱਚ ਬਾਹਰ ਬੈਠ ਜਾਂਦੀਆਂ ਸੀ ਉਹਨਾਂ ਵਿੱਚ ਇੱਕ ਸਾਡੇ ਫਰੈਂਡ ਸੀ ਉਹਨਾਂ ਨੇ ਕਿਹਾ ਵੀ ਜੋ ਹੱਥ ਦੀ ਕੋਟੀ ਹੁੰਦੀ ਹੈ ਵੀ ਬਹੁਤ ਵਧੀਆ ਆ ਅਤੇ ਕਿਤੇ ਨਾ ਕਿਤੇ ਮੈਂ ਉਹਨਾਂ ਨੂੰ ਤਾਂ ਸੰਗਦਿਆਂ ਨੂੰ ਕਿਹਾ ਨਹੀਂ ਵੀ ਮੈਨੂੰ ਕੋਟੀ ਬਣਾਉਣੀ ਨਹੀਂ ਆਉਂਦੀ ਜਾਂ ਕਿੱਦਾਂ ਵੀ ਆ ਉਹ ਬਣਾ ਰਹੇ ਸੀ ਮੈਂ ਦੇਖ ਰਹੀ ਸੀ ਮੈਨੂੰ ਉਹਨਾਂ ਨੂੰ ਦੇਖ ਕੇ ਬਹੁਤ ਉਕਸੁਕਤਾ ਹੋਈ ਵੀ ਮੈਂ ਵੀ ਕਿਤੇ ਨਾ ਕਿਤੇ ਵੀ ਆਪਣੇ ਹੱਥ ਨਾਲ ਬਣਾਵਾਂ ਅਤੇ ਔਰ ਪਾਵਾਂ ਸਟਾਰਟਿੰਗ ਮੈਂ ਕੀਤੀ ਸੀ ਇੱਕ ਟੋਪੀ ਤੋਂ ਚਲੋ ਮੇਰੀ ਟੋਪੀ ਵਧੀਆ ਲੱਗੀ ਮੈਨੂੰ ਵੀ ਮੈਂ ਬਹੁਤ ਵਧੀਆ ਬਣਾਈ ਫਿਰ ਮੈਂ ਇੱਕ ਕੋਟੀ ਦੀ ਸ਼ੁਰੂਆਤ ਕੀਤੀ ਜਿਸ ਵਿੱਚ ਮਤਲਬ ਮੈਂ ਇੱਕ ਔਨਲਾਈਨ ਐਪ ਸੀ ਔਨਲਾਈਨ ਯੂਟੀਊਬ 'ਤੇ ਕੱਢਿਆ ਸੀ ਰੋਜ਼ ਬਰਡ ਨੀਟਿੰਗ ਵਾਲੇ ਉਹਨਾਂ ਦੀ ਇੰਸਟਰਕਸ਼ਨਸ ਪੜ੍ਹ ਪੜ੍ਹ ਕੇ ਮਤਲਬ ਕਿ ਮੈਂ ਕੋਟੀ ਬਣਾਉਣੀ ਸ਼ੁਰੂ ਕਰ ਦਿੱਤੀ ਮੈਨੂੰ ਬਹੁਤ ਡਰ ਵੀ ਲੱਗ ਰਿਹਾ ਸੀ ਵੀ ਮੇਰੀ ਕੋਟੀ ਦੀ ਮੈਂ ਉਨ ਵੀ ਬਜ਼ਾਰ ਤੋਂ ਲੈ ਆਈ ਪਰ ਮੇਰੀ ਕੋਟੀ ਚੱਲ ਜਾਵੇ ਬਹੁਤ ਵਧੀਆ ਨਹੀਂ ਤਾਂ ਮੇਰੀ ਕੋਟੀ ਦਾ ਨੁਕਸਾਨ ਮੇਰੀ ਉਨ ਦਾ ਨੁਕਸਾਨ ਹੋ ਜਾਣਾ ਪਰ ਮੈਂ ਹੌਲੀ ਹੌਲੀ ਇਹਨਾਂ ਨੂੰ ਦੇਖ ਕੇ ਰੋਜ਼ ਥੋੜ੍ਹਾ ਥੋੜ੍ਹਾ ਕਰ ਕਰ ਕੇ ਸਿੱਖਣਾ ਸ਼ੁਰੂ ਕਰਤਾ ਅਤੇ ਮੈਨੂੰ ਬਹੁਤ ਆਸਾਨੀ ਵੀ ਲੱਗਣ ਲੱਗ ਪਈ ਵੀ ਮੈਂ ਕੋਟੀ ਬਣਾ ਰਹੀ ਹਾਂ ਉਸ ਵਿੱਚ ਮੇਂਨ ਫਿਰ ਉਹ ਸਟਿਚਿਸ ਲੈ ਕੇ ਮੈਂ ਆਪਣੀ ਫਰੈਂਡ ਕੋਲ ਗਈ ਜਿਹਨਾਂ ਨੇ ਮੈਨੂੰ ਸ਼ੁਰੂਆਤ ਲਈ ਕਿਹਾ ਸੀ ਮੈਂ ਉਸ ਫਰੈਂਡ ਨੂੰ ਕਿਹਾ ਵੀ ਮੈਂ ਦੀਦੀ ਇਹ ਵਾਲੀ ਕੋਟੀ ਬਣਾਉਣਾ ਚਾਹੁੰਦੀ ਹਾਂ ਥੋੜ੍ਹੀ ਮਦਦ ਮੈਨੂੰ ਉਹਨਾਂ ਨੇ ਕੀਤੀ ਉਹਨਾਂ ਨੇ ਵੀ ਔਨਲਾਈਨ ਜ ਦੇਖਿਆ ਡਿਜ਼ਾਈਨ ਉਹ ਕਹਿੰਦੇ ਚਲੋ ਕੋਈ ਨਹੀਂ ਆਪਾਂ ਟਰਾਈ ਕਰਦੇ ਹਾਂ ਟਰਾਈ ਕਰਨ ਦੇ ਵਿੱਚ ਕੀ ਹਰਜ਼ ਹੈ ਚਲੋ ਮੈਂ ਹੌਲੀ ਹੌਲੀ ਉਹਨਾਂ ਤੋਂ ਸਿੱਖਿਆ ਜੋ ਕੋਟੀ ਅਸੀਂ ਬਜ਼ਾਰ ਦੇ ਵਿੱਚੋਂ ਲੈਂਦੇ ਹਾਂ ਉਹਦੇ ਵਿੱਚ ਉਹ ਚੀਜ਼ ਦਾ ਨਿੱਘ ਨਹੀਂ ਸੀ ਜਦ ਮੈਂ ਉਹ ਕੋਟੀ ਬਣਾਈ ਆ ਪੂਰੀ ਗਰਮ ਕੋਟੀ ਬਣੀ ਮੇਰੀ ਜੋ ਮਾਰਕੀਟ ਵਿੱਚੋਂ ਲਿਆਉਂਦੇ ਚਾਹੇ ਉਹ ਬ੍ਰੈਂਡਡ ਵੀ ਹੈ ਪਰ ਉਹ ਨਿੱਘ ਨਹੀਂ ਸੀ ਹੈਗਾ ਜੋ ਮੇਰੀ ਖੁਦ ਦੀ ਕੋਟੀ ਵਿੱਚ ਸੀ ਇੱਕ ਤਾਂ ਉਹਦੀ ਹੱਥ ਦੀ ਸਫਾਈ ਬਹੁਤ ਆਈ ਕੁਛ ਆਪਣੇ ਮਨ ਨਾਲ ਬਣਾਈ ਸੀ ਅਤੇ ਉਹ ਕੋਟੀ ਜਦ ਮੈਂ ਵੇਅਰ ਕੀਤੀ ਤਾਂ ਮੈਨੂੰ ਪ੍ਰਾਊਡ ਵੀ ਫੀਲ ਹੋ ਰਿਹਾ ਸੀ ਵੀ ਮੈਂ ਇਹ ਕੋਟੀ ਖੁਦ ਬਣਾਈ ਆ ਔਨਲਾਈਨ ਹੀ ਮੈਂ ਮੇਨ ਆਪਣਾ ਕਰਨਾ ਸ਼ੁਰੂ ਕੀਤਾ ਸੀ ਥੋੜ੍ਹੀ ਬਹੁਤੀ ਫਰੈਂਡ ਤੋਂ ਜੇ ਨਹੀਂ ਸੀ ਔਨਲਾਈਨ ਤੋਂ ਕੁਛ ਮਾੜਾ ਮੋਟਾ ਨਹੀਂ ਸੀ ਪਤਾ ਲੱਗਦਾ ਉਹਦੇ ਲਈ ਮੈਂ ਆਪਣੇ ਫਰੈਂਡ ਕੋਲ ਵੀ ਚਲੇ ਜਾਂਦੀ ਹੁੰਦੀ ਸੀ ਵੀ ਦੀਦੀ ਮੈਨੂੰ ਇਹ ਤੋਂ ਸਮਝ ਨਹੀਂ ਆਉਂਦੀ ਵੀ ਤੁਸੀਂ ਮੈਨੂੰ ਇੱਥੋਂ ਥੋੜ੍ਹਾ ਜਿਹਾ ਕਲੀਅਰ ਕਰਵਾ ਦਿਉ ਵੀ ਇੱਥੋਂ ਕਿੱਦਾਂ ਕਰਨਾ ਵੀ ਜੋ ਕੁੰਡਾ ਘੁੰਮਾਉਣਾ ਜਾਂ ਕੁਛ ਕਰਨਾ ਜਾਂ ਕੁਛ ਕਾਟ ਵਗੈਰਾ 'ਚ ਥੋੜ੍ਹੀ ਬਹੁਤੀ ਕੋਈ ਦਿੱਕਤ ਆ ਵੀ ਜਾਂਦੀ ਸੀ ਮੈਂ ਆਪਣੀ ਫਰੈਂਡ ਕੋਲ ਚਲੇ ਜਾਂਦੀ ਸੀ ਮਤਲਬ ਮੈਨੂੰ ਇੰਨੀ ਕੁ ਖੁਸ਼ੀ ਹੋਈ ਵੀ ਮੈਂ ਆਪ ਕੋਟੀ ਬਣਾਈ ਉਸ ਤੋਂ ਬਾਅਦ ਫਿਰ ਮੈਂ ਇੱਕ ਆਪਣੀ ਕੋਟੀ ਬਣਾਈ ਆਪਣੇ ਫਾਦਰ ਨਾ ਦੀ ਬਣਾਈ ਆਪਣੀ ਮਦਰ ਦੀ ਬਣਾਈ ਮਤਲਬ ਮੈਂ ਆਪਣੇ ਹੱਥੀਂ ਕੰਮ ਕਰਨ ਨੂੰ ਪਹਿਲ ਦਿੰਦੀ ਹਾਂ ਵੀ ਜੋ ਚੀਜ਼ ਅਸੀਂ ਆਪ ਕਰ ਲੈਣੀ ਹੈ ਇੱਕ ਤਾਂ ਬਜ਼ਾਰ ਨਾਲੋਂ ਸਸਤੀ ਪੈਂਦੀ ਆ ਦੂਸਰਾ ਇਹ ਹੈ ਵੀ ਉਸ ਚੀਜ਼ ਦੀ ਲਾਈਫ ਬਹੁਤ ਵਧੀਆ ਹੁੰਦੀ ਆ ਵੀ ਅਸੀਂ ਜੋ ਵੀ ਬਣਾ ਰਹੇ ਹਾਂ ਇਸ ਕਰਕੇ ਮੈਂ ਤਾਂ ਲੋਕਾਂ ਨੂੰ ਇਹੀ ਕਹਿਣਾ ਚਾਹੁੰਦੀ ਹਾਂ ਵੀ ਸਭ ਤੋਂ ਵਧੀਆ ਵੀ ਆਪਣਾ ਜੋ ਵੀ ਕੰਮ ਆ ਆਪਣੀ ਹੱਥੀਂ ਮਿਹਨਤ ਨਾਲ ਕਰੋ ਜੋ ਕੰਮ ਅਸੀਂ ਕਰ ਲੈਂਦੇ ਹਾਂ ਉਹ ਕਿਤੇ ਵੀ ਨਹੀਂ ਹੈ ਜ਼ਿਆਦਾਤਰ ਮੈਨੂੰ ਯੂਟਿਊਬ 'ਤੇ ਰੋਜ਼ ਬਰਡ ਨੀਟਿੰਗ ਵਾਲਿਆਂ ਦੀਆਂ ਵੀਡੀਓਜ਼ ਬਹੁਤ ਵਧੀਆ ਲੱਗਦੀਆਂ ਉਹ ਡਿਜ਼ਾਇਨਿੰਗ ਇੰਨੀ ਕੁ ਵਧੀਆ ਦੇ ਦਿੰਦੇ ਨੇ ਜਿਨ੍ਹਾਂ ਨੂੰ ਮਤਲਬ ਸਮਝਣ 'ਚ ਕਰਨ 'ਚ ਕੋਈ ਇੰਨੀ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਮਤਲਬ ਕਿ ਆਪਾਂ ਜੋ ਬੰਦੇ ਪਹਿਲਾਂ ਨੀਟਿੰਗ ਕਰਦੇ ਨੇ ਉਹਨਾਂ ਨੂੰ ਤਾਂ ਕੋਈ ਔਖਾ ਨਹੀਂ ਲੱਗਦਾ ਪਰ ਮੈਂ ਫਸਟ ਟਾਈਮ ਕੀਤੀ ਸੀ ਇਸ ਕਰਕੇ ਥੋੜ੍ਹਾ ਬਹੁਤਾ ਮੈਂ ਆਪਣੀ ਫਰੈਂਡ ਦਾ ਸਹਾਰਾ ਲਿਆ ਸੀ ਥੋੜ੍ਹਾ ਬਹੁਤਾ ਮੈਂ ਆਪਣੀ ਮਤਲਬ ਯੂਟਿਊਬ ਤੋਂ ਵੀਡੀਓਜ਼ ਦੇਖ ਕੇ ਕੀਤਾ ਸੀ ਅਤੇ ਮੇਰੀ ਕੋਟੀ ਸਿਰੇ ਚੜ੍ਹ ਗਈ ਅੱਜ ਮੈਂ ਪਾਈ ਫਿਰਦੀ ਹਾਂ